ਟੈਕਨੋਲੋਜੀ ਨੇ ਤਾਂ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਬਦਲ ਕੇ ਰੱਖ ਦਿੱਤਾ ਹੈ ਟੈਕਨੋਲੋਜੀ ਸਾਡੇ ਕੰਮ ਦੇ ਵਿੱਚ ਬਹੁਤ ਹੀ ਤੇਜ਼ੀ ਨਾਲ ਅੱਗੇ ਵਧੀ ਹੈ ਅੱਗੇ ਅਸੀਂ ਝੱਬਲ ਹਥੋੜੀ ਜਾਂ ਆਰੀ ਨਾਲ ਮਾਲ ਵੱਢਦੇ ਸੀ ਹੁਣ ਸਾਨੂੰ ਗਰੈਂਡਰ ਡਰਿੱਲ ਮਸ਼ੀਨਾਂ ਹੈਂਬਰ ਮਸ਼ੀਨਾਂ ਈਵਨ ਕਿ ਛੋਟੇ ਬੈਲਡਿੰਗ ਸੈੱਟ ਵੀ ਟੈਕਨੋਲੋਜੀ ਥਰੂ ਸਾਨੂੰ ਮਿਲ ਗਏ ਹਨ ਜੋ ਕਿ ਬਹੁਤ ਹੀ ਅਫੋਰਡੇਬਲ ਹੈ ਕਿਤੇ ਵੀ ਜਾਣਾ ਹੋਵੇ ਬਹੁਤ ਈਜ਼ੀਲੀ ਅਸੀਂ ਕੈਰੀ ਕਰਕੇ ਉਹਨੂੰ ਲੈ ਜਾਂਦੇ ਹਾਂ ਭਾਵੇਂ ਦਸ ਮੰਜ਼ਿਲਾਂ ਚੜਾਣੀਆ ਹੁੰਦੀਆਂ ਸੀ ਅੱਗੇ ਵੈਲਡਿੰਗ ਸੈੱਟ ਵੱਡੇ ਹੋਣ ਕਰਕੇ ਬਹੁਤ ਹੀ ਪਰੇਸ਼ਾਨੀ ਹੁੰਦੀ ਸੀ ਸਾਨੂੰ ਮੇਨ ਤਾਰਾਂ ਲੱਭਣੀਆਂ ਪੈਂਦੀਆਂ ਸੀ ਹੁਣ ਛੋਟੀ ਵੈਲਡਿੰਗ ਸੈੱਟ ਆਉਣ ਨਾਲ ਅਸੀਂ ਜਿੱਥੇ ਮਰਜ਼ੀ ਆਪਣੀ ਤਾਰ ਲਗਾ ਲੈਂਦੇ ਹਾਂ ਅਤੇ ਆਪਣਾ ਕੰਮ ਬਹੁਤ ਹੀ ਸੌਖੇ ਤਰੀਕੇ ਨਾਲ ਕਰਕੇ ਆਰਾਮ ਨਾਲ ਵਾਪਿਸ ਆ ਜਾਂਦੇ ਹਾਂ ਇਸ ਨਾਲ ਸਾਡੀ ਟਾਈਮ ਦੀ ਬਹੁਤ ਹੀ ਬੱਚਤ ਹੁੰਦੀ ਹੈ ਲੇਬਰ ਦੀ ਬਹੁਤ ਹੀ ਘੱਟ ਵਰਤੋਂ ਹੁੰਦੀ ਹੈ ਜਿਸ ਨਾਲ ਸਾਡਾ ਮਾਰਜਨ ਅਤੇ ਕੋਸਟ ਸਾਨੂੰ ਵੱਧ ਗਈ ਹੈ ਅਸੀਂ ਟੈਕਨੋਲੋਜੀ ਦਾ ਧੰਨਵਾਦ ਕਰਦੇ ਹਾਂ ਦੂਸਰਾ ਸਾਨੂੰ ਜੋ ਕਿ ਇਸ ਟ ਪਲੈਟਫਾਰਮ ਦਿੱਤੇ ਹਨ ਸੋਸ਼ਲ ਮੀਡੀਆ 'ਤੇ ਪਲੈਟਫਾਰਮ ਦਿੱਤੇ ਹਨ ਉਹਨਾਂ ਵਿੱਚ ਫੇਸਬੁੱਕ ਵਟਸਐਪ ਆਦਿ ਹਨ ਫੇਸਬੁੱਕ ਸਾਨੂੰ ਅਸੀਂ ਆਪਣੀਆਂ ਜੋ ਕਿ ਅਪਲੋਡ ਕਰ ਦਿੰਦੇ ਹਾਂ ਫੋਟੋਆਂ ਜਿਹਨੂੰ ਦੇਖ ਕੇ ਕਸਟਮਰ ਸਾਡੇ ਕੋਲ ਭੱਜਿਆ ਭੱਜਿਆ ਆਉਂਦਾ ਹੈ ਅਤੇ ਸਾਨੂੰ ਹੋਰ ਵੀ ਆਡਰ ਮਿਲਦੇ ਹਨ